ਯੋਗਾ ਕਰਨ ਦੀ ਕੋਈ ਉਮਰ ਨਹੀਂ ਛੋਟੀ ਉਮਰ ਵਿੱਚ ਵੀ ਬੱਚਾ ਸ਼ ਯੋਗਾ ਸ਼ੁਰੂ ਕਰ ਸਕਦਾ ਹੈ ਛੋਟੀ ਉਮਰ 'ਚ ਯੋਗਾ ਕਰਨ ਦੇ ਕਈ ਫਾਇਦੇ ਹਨ ਇੱਕ ਤਾਂ ਬੱਚਿਆਂ ਦੀ ਹਾਈਟ ਵਧੀਆ ਰਹਿੰਦੀ ਆ ਇੱਕ ਬੱਚਿਆਂ ਦੀ ਪਾਚਣ ਸ਼ਕਤੀ ਬਹੁਤ ਬਣਦੀ ਯੋਗ ਕਰਨ ਨਾਲ ਅਤੇ ਬੱਚਿਆਂ ਨੂੰ ਬੱਚਿਆਂ ਦੇ ਚਿਹਰੇ 'ਤੇ ਰੌਣਕ ਰਹਿੰਦੀ ਹੈ ਬੱਚਾ ਪੂਰਾ ਦਿਨ ਹੱਸਦਾ ਖੇਡਦਾ ਰਹਿੰਦਾ ਗਾ ਬੱਚਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਬੱਚਿਆਂ ਦੇ ਫੇਫੜੇ ਫੁਫੜੇ ਵਧੀ ਵਧੀਆ ਕੰਮ ਕਰਦੇ ਆ ਬੱਚਿਆਂ ਨੂੰ ਸਾਹ ਲੈਣ 'ਚ ਕੋਈ ਦਿੱਕਤ ਨਹੀਂ ਆਉਂਦੀ ਗੀ ਕੋਈ ਬਿਮਾਰੀ ਸ਼ਮਾਰੀ ਹੁੰਦੀ ਬੱਚਿਆਂ ਨੂੰ ਛੋਟੀ ਉਮਰ ਚ ਲੱਗ ਜਾਂਦੀ ਉਹ ਵੀ ਠੀਕ ਹੋ ਜਾਂਦੀ ਆ ਅਤੇ ਬੱਚਿਆਂ ਦੀ ਹਾਈਟ ਬਾਈਟ ਬੱਚੇ ਕੱਦ ਵਧੀਆ ਕਰਦੇ ਆ ਅਤੇ ਸਰੀਰ ਚ ਮੋਟਾਪਾ ਨਹੀਂ ਆਉਂਦਾ ਬੱਚਿਆਂ ਨੂੰ ਪਾਚਨ ਸ਼ਕਤੀ ਵਧੀਆ ਬਣੀ ਰਹਿੰਦੀ ਆ ਕੱਦ ਕਾਠ ਵੀ ਵਧੀਆ ਬਣਦਾ ਹੈਗਾ ਬੱਚਿਆਂ ਦਾ ਬੱਚੇ ਮਤਲਬ ਫਰੈਸ਼ ਰਹਿੰਦੇ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੇ ਯੋਗ ਕਰਨ ਨਾਲ ਬੱਚੇ ਮਾਇੰਡ ਬੜਾ ਫਰੈਸ਼ ਹੁੰਦਾ ਪੜ੍ਹਾਈ ਵਿੱਚ ਵੀ ਹੁਸ਼ਿਆਰ ਨਿਕਲਦੇ ਬੱਚੇ ਅਤੇ ਉਹਨਾਂ ਦਾ ਮਾਇੰਡ ਵੀ ਵਧੀਆ ਕੰਮ ਕਰਦਾ ਗਾ ਅਤੇ ਬੱਚਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਯੋਗਾ ਕਰਦਾ ਰਵੇ ਤਾਂ ਬੱਚਾ ਵੱਡੀ ਮਤਲਬ ਜਵਾਨੀ ਵਿੱਚ ਆਉਂਦਾ ਆਉਂਦਾ ਬੱਚਾ ਵਧੀਆ ਕੱਦ ਕਾਠ ਵਾਲਾ ਬਣ ਜਾਂਦਾ ਗਾ ਪਾਚਨ ਸ਼ਕਤੀ ਬੱਚੇ ਦੀ ਵਧੀਆ ਹੋ ਜਾਂਦੀ ਆ ਬੱਚਾ ਤੰਦਰੁਸਤ ਹੁੰਦਾ